ਮੈਂ ਆਨਲਾਈਨ ਔਫਲਾਈਨ ਕਾਫੀ ਚੀਜ਼ਾਂ ਖਰੀਦੀਆਂ ਹਨ ਅਤੇ ਜ਼ਿਆਦਾਤਰ ਜਿਹੜੀ ਮੈਂ ਚੀਜ਼ਾਂ ਔਫਲਾਈਨ ਖਰੀਦੀਆਂ ਹਨ ਉਹਨਾਂ ਦੇ ਲਈ ਮੇਰਾ ਕਾਫੀ ਵਧੀਆ ਆਪਣਾ ਅਨੁਭਵ ਰਿਹਾ ਹੈ ਕਿਉਂਕਿ ਆਫਲਾਈਨ ਚੀਜ਼ਾਂ ਜਿਹੜੀ ਅਸੀਂ ਆਪ ਦੁਕਾਨਾਂ ਕੋਲ ਜਾ ਕੇ ਚੀਜ਼ ਨੂੰ ਦੇਖ ਕੇ ਖਰੀਦੇ ਹਾਂ ਉਹ ਆਨਲਾਈਨ ਚੀਜ਼ਾਂ ਨਾਲੋਂ ਕਾਫੀ ਵਧੀਆ ਹੁੰਦੀਆਂ ਹਨ ਆਨਲਾਈਨ ਚੀਜ਼ ਦੇ ਚ ਮੈਂ ਕਾਫੀ ਚੀਜ਼ਾਂ ਮੰਗਵਾਈਆਂ ਨੇ ਅਤੇ ਹੱਦ ਤੱਕ ਠੀਕ ਜਿਵੇਂ ਕੱਪੜੇ ਵਗੈਰਾ ਹੋ ਗਏ ਆਪਣਾ ਬਿਜਲੀ ਦਾ ਸਮਾਨ ਹੋ ਗਿਆ ਹੈਡਫੋਨ ਵਗੈਰਾ ਹੋ ਗਏ ਮੰਗਾਵਾਏ ਨੇ ਅਤੇ ਮਤਲਬ ਕਿ ਹਰੇਕ ਸਮਾਨ ਦੇ ਵਿੱਚ ਕੁਛ ਨਾ ਕੁਛ ਕਮੀ ਹੁੰਦੀ ਹੈ ਜਿਹੜੀ ਕਿ ਮੈਨੂੰ ਹਰੇਕ ਵਾਰ ਇਹੀ ਮਹਿਸੂਸ ਕਰਵਾਉਂਦੀ ਹੈ ਕਿ ਆਨਲਾਈਨ ਜਿਹੜੀ ਅਸੀਂ ਖਰੀਦਦਾਰੀ ਕਰਦੇ ਹਾਂ ਉਹ ਘੱਟ ਆਫਲਾਈਨ ਨਾਲੋਂ ਘੱਟ ਵਧੀਆ ਹੈ ਜਿਵੇਂ ਮੈਂ ਇੱਕ ਵਾਰ ਸੂਟ ਮੰਗਵਾਇਆ ਸੀ ਇੱਕ ਮਤਲਬ ਕਿ ਫਰੋਕ ਸੂਟ ਮੰਗਵਾਇਆ ਸੀ ਉਹਦੇ ਵਿੱਚ ਇਹ ਕਮੀ ਸੀ ਕਿ ਮੈਂ ਰੰਗ ਕੋਈ ਹੋਰ ਮੰਗਵਾਇਆ ਸੀ ਅਤੇ ਮੈਨੂੰ ਕੋਈ ਹੋਰ ਰੰਗ ਆ ਗਿਆ ਮੈਂ ਮੰਗਵਾਇਆ ਸੀ ਨਾਭੀ ਰੰਗ ਅਤੇ ਜਿਹੜਾ ਰੰਗ ਮੈਨੂੰ ਆਂਏਂ ਸੀ ਉਹ ਸੀ ਜਾਮਣੀ ਅਤੇ ਜਿਸ ਹਿਸਾਬ 'ਚ ਫੋਟੋ ਦੇ ਵਿੱਚੋਂ ਫਰੋਕ ਦਿਖਾਈ ਗਈ ਸੀ ਉਸ ਹਿਸਾਬ ਸਿਰ ਦੇ ਉਹ ਅਸਲ ਦੇ ਵਿੱਚ ਹੈ ਨਹੀਂ ਸੀ ਇਸ ਕਰਕੇ ਮੈਨੂੰ ਇਹ ਚੀਜ਼ ਕਾਫੀ ਨਕਾ ਨਕਾਰਾਤਮਕ ਲੱਗੀ ਅਤੇ ਦੂਜੀ ਚੀਜ਼ ਮੈਂ ਇੱਕ ਵਾਰੀ ਮੰਗਵਾਏ ਸੀ ਲੇ ਹੈਡਫੋਨ ਵਗੈਰਾ ਫੋਟੋ ਦੇ ਵਿੱਚ ਉਹ ਬਹੁਤ ਵਧੀਆ ਦਿੱਖ ਰਹੇ ਸੀ ਉਹਦੇ ਵਿੱਚ ਆਪਣਾ ਸਿਰ ਵਲ ਸਿਲਵਰ ਕਲਰ ਦੀ ਸੀ ਉਹ ਅਤੇ ਉਹਦੇ ਵਿੱਚ ਜਿਹੜਾ ਆਪਣਾ ਪੁਆਇੰਟ ਹੁੰਦਾ ਆ ਓਨ ਓਫ ਕਰਨ ਦਾ ਆਪਣਾ ਆਵਾਜ਼ ਨੂੰ ਵਧਾਉਣ ਦਾ ਆਵਾਜ਼ ਨੂੰ ਘਟਾਉਣ ਦਾ ਉਸ ਕਰਕੇ ਮੈਂ ਉਸ ਹੈਡਫੋਨ ਨੂੰ ਓਰਡਰ ਕੀਤਾ ਅਤੇ ਉਹਦੇ ਵਿੱਚ ਜਿਹੜੇ ਹੈਡਫੋਨ ਦੇ ਡਾਟੇ ਹੁੰਦੇ ਹਨ ਉਹ ਮਲ ਕਿ ਸਾਡੇ ਕੋਲ ਦੋ ਤੋਂ ਇਲਾਵਾ ਦੋ ਹੋਰ ਵੱਧ ਹੈਗੇ ਸੀ ਬਟ ਜਦੋਂ ਮੈਂ ਓਰਡਰ ਓਰਡਰ ਕਰਕੇ ਜਦੋਂ ਪ੍ਰੋਡਕਟ ਮੇਰੇ ਕੋਲ ਆਇਆ ਤਾਂ ਮੈਂ ਦੇਖਿਆ ਕਿ ਐਕਚੁਅਲ ਦੇ ਵਿੱਚ ਜੋ ਪ੍ਰੋਡਕਟ ਦਿਖਾਇਆ ਗਿਆ ਸੀ ਉਹ ਅਸਲ ਦੇ ਵਿੱਚ ਉਵੇਂ ਦਾ ਨਹੀਂ ਸੀ ਉਸ ਤਾਰ ਦੀ ਲੈਂਥ ਬਹੁਤ ਜ਼ਿਆਦਾ ਘੱਟ ਸੀ ਅਤੇ ਜਿਹੜੀ ਉਹਦੇ ਵਿੱਚ ਉਹਨਾਂ ਨੇ ਡਾਟੇ ਯੂਜ਼ ਡਾਟੇ ਇਸਤੇਮਾਲ ਕੀਤੇ ਗਏ ਸੀ ਉਹਦੇ ਵਿੱਚ ਸਿਰਫ ਤਿੰਨ ਡਾਟੇ ਸੀ ਇੱਕ ਡਾਟਾ ਪਤਾ ਨਹੀਂ ਕਿੱਥੇ ਰਹਿ ਗਏ ਕਿੱਥੇ ਨਹੀਂ ਅਤੇ ਇਸ ਕਰਕੇ ਨਾ ਅਸੀਂ ਟਾਈਮ ਆਪਣਾ ਆਨਲਾਈਨ ਜਾ ਕੇ ਉਸ ਪ੍ਰੋਡਕਟ ਬਾਰੇ ਆਪਣੀ ਅਨੁਭਵ ਦਿੱਤਾ ਕਿ ਇਹਨਾਂ ਦੀ ਮਤਲਬ ਕਿ ਸਰਵਿਸ ਵਗੈਰਾ ਵਧੀਆ ਨਹੀਂ ਹੈਗੀ ਅਤੇ ਇਹ ਮੇਰੇ ਲਈ ਬਹੁਤ ਨਕਾਰ ਨਕਾਰਾਤਮਕ ਅਨੁਭਵ ਰਿਹਾ ਹੈ